ਪੰਜਾਬ ਵਿੱਚ ਪਛੜੇ ਜਾਂ ਹਾਸ਼ੀਏ 'ਤੇ ਰਹਿ ਰਹੇ ਭਾਈਚਾਰਿਆਂ ਵਿੱਚ ਉਹ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਸਾਰੇ ਪ੍ਰੋਗਰਾਮ ਕੀਤੇ ਗਏ ਹਨ ਜਿਵੇਂ ਕਿ ਬੇਟੀ ਬਚਾਓ ਬੇਟੀ ਪੜਾਓ ਬੇਟੀ ਬਚਾਓ ਬੇਟੀ ਪੜਾਓ ਇਹ ਜੋ ਪ੍ਰੋਗਰਾਮ ਹੈ ਇਹ ਬਹੁਤ ਹੀ ਵਧੀਆ ਕਿਉਂਕਿ ਅੱਜ ਕੱਲ੍ਹ ਕੀ ਕਰਦੇ ਹਨ ਸਭ ਤੋਂ ਪਹਿਲੇ ਹੀ ਡੀ ਐੱਨ ਏ ਟੈਸਟ ਵਗੈਰਾ ਵਿੱਚ ਦੇਖ ਲੈਂਦੇ ਹਨ ਕਿ ਅਗਰ ਤਾਂ ਬੇਟੀ ਹੋ ਰਹੀ ਹੈ ਤਾਂ ਉਹਨੂੰ ਪੇਟ ਦੇ ਗਰਭ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਹੀ ਵੱਡੀ ਗਲਤੀ ਹੈ ਸਰਕਾਰ ਨੇ ਇਹ ਆਯੋਜਿਤ ਕੀਤਾ ਗਿਆ ਹੈ ਕਿ ਜਿਹੜੇ ਬੇਟੀ ਬਚਾਓ ਬੇਟੀ ਪੜਾਓ ਨੂੰ ਦੇ ਪੂਰਾ ਯੋਗਦਾਨ ਦੇਣਗੇ ਉਹਨਾਂ ਜਿਨ੍ਹਾਂ ਦੇ ਘਰ ਬੇਟੀ ਹੋਏਗੀ ਉਹਨਾਂ ਨੂੰ ਬਹੁਤ ਸਾਰੇ ਅਹ ਮਤਲਬ ਸਰਕਾਰ ਦੇ ਵੱਲੋਂ ਪੈਸੇ ਦਿੱਤੇ ਜਾਣਗੇ ਉਹਦੀ ਪੜ੍ਹਾਈ ਦਾ ਪੂਰਾ ਖਰਚਾ ਕੀਤਾ ਜਾਏਗਾ ਉਹਦਾ ਵਿਆਹ ਤੱਕ ਕਰ ਨ ਸਰਕਾਰ ਵੱਲੋਂ ਹੀ ਹੋਇਆ ਜਾਏਗਾ ਇਸ ਲਈ ਮੇ ਮੇਰੇ ਲਈ ਤਾਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਬਹੁਤ ਹੀ ਜ਼ਿਆਦਾ ਵਧੀਆ ਫਾਇਦੇਮੰਦ ਮੰਦੀ ਮੰਨੀ ਜਾਂਦੀ ਹੈ ਅਤੇ ਫਿਰ ਪੋਸਟ ਮੈਟ੍ਰਿਕ ਸਕੋਲਰਸ਼ਿਪ ਪੋਸਟ ਮੈਟ੍ਰਿਕ ਸਕੋਲਰਸ਼ਿਪ ਜਿਵੇਂ ਕਿ ਮੈਂ ਕੋਲਜ ਵਿੱਚ ਪੜ੍ਹਦੀ ਹੀ ਰਹੀ ਹਾਂ ਪੜ੍ਹ ਚੁੱਕੀ ਹਾਂ ਉੱਥੇ ਮੇਰੇ ਬਹੁਤ ਸਾਰੇ ਇੱਦਾਂ ਦੇ ਦੋਸਤ ਸੀਗੇ ਜਿਨ੍ਹਾਂ ਨੂੰ ਉਹ ਸਰਕਾਰ ਦੇ ਵੱਲੋਂ ਪੋਸਟ ਮੈਟ੍ਰਿਕ ਸਕੋਲਰਸ਼ਿਪ ਦਾ ਲਾਭ ਦਿੱਤਾ ਗਿਆ ਹੋਇਆ ਸੀ ਉਹ ਸਰਕਾਰ ਕੀ ਜਿਹਨਾਂ ਦੀ ਦੂਜੀ ਜਾਤ ਹੈਗੀ ਹੈ ਉਹਨਾਂ ਨੂੰ ਬਹੁਤ ਹੀ ਮਤਲਬ ਪੂਰੀ ਇਹ ਪੜ੍ਹਾਈ ਦਾ ਪੂਰਾ ਖਰਚ ਉਠਾਉਂਦੇ ਹੁੰਦੇ ਸੀ ਉਹਨਾਂ ਨੂੰ ਅਲੱਗ ਪੈਸੇ ਵੀ ਦਿੱਤੇ ਜਾਂਦੇ ਹੁੰਦੇ ਸਨ ਪੜ੍ਹਨ ਲੀਏ ਜਿਨ੍ਹਾਂ ਅਹ ਉਹਨਾਂ ਨੂੰ ਪੀ ਐੱਮ ਐੱਸ ਜੋ ਸਕੋਲਰਸ਼ਿਪ ਹੈ ਉਹ ਦਿੱਤੀ ਜਾਂਦੀ ਹੁੰਦੀ ਸੀ ਜਿਹਦੇ ਕਰਕੇ ਉਹ ਲੋਕ ਵੀ ਪਿੱਛੇ ਨਾ ਰਹਿ ਪਵਣ ਉਹ ਵੀ ਆਪਣੇ ਚੰਗੀ ਤਰ੍ਹਾਂ ਪੂਰੀ ਪੜ੍ਹਾਈ ਕਰ ਸਕਣ ਹ ਇਹ ਸਰਕਾਰ ਦੇ ਵੱਲੋਂ ਸਾਰੀ ਸੁਵਿਧਾਵਾਂ ਹਾਂ ਸਾਨੂੰ ਉਹ ਮਿਲ ਚੁੱਕੀਆਂ ਹਨ